ਮੈਂ ਦੋ ਮਹੀਨੇ ਪਹਿਲਾਂ ਐਮਾਜੋਨ ਉੱਤੇ ਰੈੱਡਮੀ ਪਰੋ ਮੈਕਸ ਮੋਬਾਇਲ ਖਰੀਦਿਆ ਸੀ ਅਤੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਇਹ ਬਹੁ ਇਸਦੀ ਕੋਆਲੀਟੀ ਬਹੁਤ ਵਧੀਆ ਹੈ ਅਤੇ ਇਹ ਬਹੁਤ ਹੀ ਜ਼ਿਆਦਾ ਐੱਚ ਡੀ ਕੋਆਲਟੀ ਵਿ ਵਿੱਚ ਉਪਲਬਧ ਹੈ ਇਸਦੀ ਚਾਰਜਿੰਗ ਬਹੁਤ ਜਲਦ ਹੁੰਦੀ ਹੈ ਅਤੇ ਨਾਲ ਹੀ ਇਸ ਦਾ ਬੈਟਰੀ ਬੈਕਅੱਪ ਵੀ ਬਹੁਤ ਜ਼ਿਆਦਾ ਹੈ ਨਾਲ ਦੀ ਨਾਲ ਇਸਦੀ ਕੈਮਰਾ ਕੋਆਲੀਟੀ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਅਤੇ ਮੇਰੇ ਮੁਤਾਬਕ ਇਹ ਮੋਬਾਇਲ ਫ਼ੋਨ ਬਹੁਤ ਜ਼ਿਆਦਾ ਵਧੀਆ ਹੈ